ਚਾਰ ਲੱਖ ਚਾਲ਼ੀ ਹਜ਼ਾਰ ਚਾਰ ਸੌ ਚੁਤਾਲੀ ਪੰਜ ਲੱਖ ਦਸ ਹਜ਼ਾਰ ਇੱਕ ਸੌ ਗਿਆਰਾਂ ਦੋ ਲੱਖ ਗਿਆਰਾਂ ਹਜ਼ਾਰ ਇੱਕ ਸੌ ਇੱਕ ਤਿੰਨ ਲੱਖ ਇੱਕੀ ਹਜ਼ਾਰ ਸੱਤ ਸੌ ਇੱਕੀ ਇੱਕ ਲੱਖ ਇਕਵੰਜਾ ਹਜ਼ਾਰ ਛੇ ਸੌ ਇੱਕੀ